ਪੰਜਾਬ ਵਿੱਚ ਪ੍ਰਸਿੱਧ ਸੈਲਾਨੀ ਆਕਰਸ਼ਨ ਕਾਫੀ ਹਨ ਜੋ ਸੈਲਾਨੀਆਂ ਲਈ ਮਨੋਰੰਜਨ ਅਤੇ ਵਿਕਲਪ ਪੇਸ਼ ਕਰਦੇ ਹਨ ਜਿਵੇਂ ਥੀਮ ਪਾਕ ਵੋਟਰ ਪਾਕ ਚਿੜੀਆ ਘਰ ਮਨੋਰੰਜਨ ਪਾਕ ਜਿਵੇਂ ਕਿ ਚਿੜੀਆ ਘਰ ਵਿੱਚ ਬੱਚੇ ਵੱਖ ਵੱਖ ਤਰ੍ਹਾਂ ਦੇ ਜਾਨਵਰ ਚਿੜੀਆ ਕਾਫੀ ਕੁਛ ਦੇਖ ਸਕਦੇ ਹਨ ਅਤੇ ਉਹਨਾਂ ਦਾ ਮਨੋਰੰਜਨ ਹੋ ਸਕਦਾ ਹੈ ਚਿੜੀਆ ਘਰ ਜਿਵੇਂ ਜ਼ੁ ਜ਼ੂ ਹੋ ਗਿਆ ਚੰਡੀਗੜ੍ਹ ਵਿੱਚ ਉੱਥੇ ਜਾ ਕੇ ਉਹ ਦੇਖ ਸਕਦੇ ਹਨ ਅਤੇ ਮਨੋਰੰਜਨ ਪਾਕ ਵਿੱਚ ਕਾਫੀ ਐਂਟਰਟੇਨਮੈਂਟ ਜੋ ਮਨੋਰੰਜਨ ਬੱਚਿਆਂ ਦਾ ਹੋ ਸਕਦਾ ਹੈ ਉਹ ਉਹਦੇ ਵਿੱਚ ਵੀ ਜਾ ਕੇ ਕਾਫੀ ਚੀਜ਼ਾਂ ਦੇਖ ਸਕਦੇ ਹਨ ਉਹ ਆਪਣੇ ਪਰਿਵਾਰ ਨਾਲ ਜਾ ਕੇ ਦੇਖਦੇ ਹਨ ਜਿਵੇਂ ਚਿੜੀਆ ਘਰ ਜਿਹੜਾ ਚੰਡੀਗੜ੍ਹ ਵਿੱਚ ਹੈ ਉਹ ਸਾਰੇ ਉੱਥੇ ਜਾਣਾ ਪਸੰਦ ਕਰਦੇ ਹਨ ਸਕੂਲ ਸਕੂਲ ਤੋਂ ਬੱਚਿਆਂ ਬੱਚਿਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਵੋਟਰ ਪਾਕ ਵਿੱਚ ਬੱਚੇ ਨਹਾ ਸਕਦੇ ਹਨ ਅਤੇ ਕਾਫੀ ਤਰ੍ਹਾਂ ਦੀਆਂ ਕਾਫੀ ਤਰ੍ਹਾਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਹੁੰਦੀਆਂ ਹਨ ਉਹਨਾਂ ਨੂੰ ਥੀਮ ਪਾਕ ਵਿੱਚ ਉਹਨਾਂ ਨੂੰ ਕਾਫੀ ਤਰ੍ਹਾਂ ਦੇ ਥੀਮ ਮਿਲਦੇ ਹਨ ਜਿੱਥੇ ਉਹਨਾਂ ਨੂੰ ਬੋਲਣਾ ਪੈਂਦਾ ਹੈ